ਸਤਿ ਸ਼੍ਰੀ ਅਕਾਲ ਜੀ ਤੁਸੀਂ ਭੈਣਾਂ ਦੇ ਢਾਬੇ ਤੋਂ ਗੱਲ ਕਰ ਰਹੇ ਹੋ ਅਗਲੇ ਐਤਵਾਰ ਨੂੰ ਮੇਰਾ ਜਨਮਦਿਨ ਹੈ ਜਿਸ ਦੇ ਸਬੰਧ ਵਿੱਚ ਮੈਂ ਆਪਣਾ ਜਨਮ ਦਿਨ ਤੁਹਾਡੇ ਢਾਬੇ 'ਤੇ ਮਨਾਉਣਾ ਚਾਹੁੰਦੀ ਹਾਂ ਇਸ ਵਿੱਚ ਮੇਰੇ ਸਾਰੇ ਪਰਿਵਾਰ ਅਤੇ ਮੇਰੇ ਕੁਝ ਖਾਸ ਮਿੱਤਰ ਆਉਣਗੇ ਸਭ ਤੋਂ ਪਹਿਲਾਂ ਸਾਨੂੰ ਸਨੈਕਸ ਜਿਸ ਵਿੱਚ ਸਾਨੂੰ ਸਪਰਿੰਗ ਰੋਲ ਚਿੱਲੀ ਪਟੈਟੋ ਚਾਹੀਦੇ ਹਨ ਅਤੇ ਉਸ ਤੋਂ ਬਾਅਦ ਡਾਂਸ ਕਰ ਕੀਤਾ ਜਾਵੇਗਾ ਅਤੇ ਲੰਚ ਵਿੱਚ ਸਾਨੂੰ ਚਿੱਲੀ ਪਨੀਰ ਕੜਾਹੀ ਪਨੀਰ ਮਿਕਸ ਵੈਜ ਔਰ ਨਾਨ ਚਾਹੀਦੇ ਹਨ ਅਤੇ ਪੇਅਮੈਂਟ ਔਫਲਾਈਨ ਜਾਂ ਔਨਲਾਈਨ ਜਿਵੇਂ ਵੀ ਹੋਣੀ ਹੈ ਤੁਸੀਂ ਸਾਨੂੰ ਉਸਦੇ ਸਬੰਧ ਵਿੱਚ ਦੱਸਿਆ ਜਾਵੇ ਅਤੇ ਜੇਕਰ ਤੁਹਾਡਾ ਐਤਵਾਰ ਨੂੰ ਢਾਬਾ ਬੰਦ ਹੈ ਤਾਂ ਹੋਮ ਡਿਲੀਵਰੀ ਤੁਸੀਂ ਘਰ ਕਰ ਸਕਦੇ ਹੋ ਜਾਂ ਨਹੀਂ ਇਸਦੇ ਸੰਬੰਧ ਵਿੱਚ ਵੀ ਦੱਸਿਆ ਜਾਵੇ ਮੈਂ ਤੁਹਾਡੀ ਬਹੁਤ ਧੰਨਵਾਦੀ ਹੋਵਾਂਗੀ